ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਨਹੀਂ ਜੀ ਸਾਫ਼ ਸਫ਼ਾਈ ਤਾਂ ਅਸੀਂ ਬਹੁਤ ਰੱਖਦੇ ਹਾਂ ਜੀ

ਹਾਂਜੀ ਹਾਂਜੀ ਕਈ ਵਾਰੀ ਵਿੱਚੋਂ ਵਿੱਚ ਸਾ ਕਿਤੇ ਵੀ ਜਾ ਵੜਦਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਹਾਂਜੀ ਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਹਾਂਜੀ ਜੀ ਹਾਂਜੀ

ਹਾਂਜੀ ਜੀ ਅੱਛਾ ਕੋਈ ਨਹੀਂ ਜੀ ਅਸੀਂ ਕੁੱਕ ਜਾਂ ਤਾਂ ਕੁੱਕ ਬਦਲ ਦੇਵਾਂਗੇ ਜਾਂ ਖਾਣਾ ਬਾਹਰੋਂ ਲਿਆ ਦਿਆ ਕਰਾਂਗੇ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਜੀ

ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਹਾਂਜੀ ਕੋਈ ਨਹੀਂ ਜੀ ਅਸੀਂ ਪੂਰਾ ਧਿਆਨ ਰੱਖਾਂਗੇ ਜੀ ਹਾਂਜੀ

ਠੀਕ ਹੈ ਜੀ ਠੀਕ ਹੈ ਹਾਂਜੀ ਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ